ਮੈਂ ਆਪਣੇ ਆਲੇ ਦੁਆਲੇ ਅਗਰ ਪੰਛੀਆਂ ਦੀ ਗੱਲ ਕਰਾਂ ਤਾਂ ਮੈਂ ਕਾਫ਼ੀ ਸਾਰੇ ਪੰਛੀ ਵੇਖਦੀ ਹਾਂ ਜਿਸ ਤਰ੍ਹਾਂ ਚਿੜੀਆਂ ਹੋ ਗਏ ਤੋਤੇ ਕਾਫ਼ੀ ਸਾਰੇ ਪੰਛੀ ਹੈ ਜੋ ਚਹਿਚਹਾਉਂਦੇ ਅੱਛੇ ਲੱਗਦੇ ਹਨ ਪਰ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਇਸ ਨੈੱਟਵਰਕ ਨੇ ਕਾਫ਼ੀ ਇਸ ਪੰਛੀਆਂ ਨੂੰ ਬੁਰੀ ਮਾਰ ਪਾਈ ਹੋਈ ਹੈ ਪਰ ਕਿਤੇ ਨਾ ਕਿਤੇ ਹੁਣ ਸਰਕਾਰ ਕੋਈ ਉਪਰਾਲੇ ਕਰ ਰਹੀਆਂ ਹਨ ਇਹਨਾਂ ਪੰਛੀਆਂ ਬਚਾਉਣ ਲਈ ਅਤੇ ਜਿਹਦੇ ਨਾਲ਼ ਮੈਂ ਦੇਖਦੀ ਹਾਂ ਕਿ ਜਿਹੜੇ ਚਿੜੀਆਂ ਪਹਿਲੇ ਖ਼ਤਮ ਹੋ ਚੁੱਕੀਆਂ ਹਨ ਸਨ ਉਹਨਾਂ ਨੂੰ ਮੈਂ ਦੁਬਾਰਾ ਕਈ ਵਾਰ ਦੇਖਿਆ ਆ ਆਪਣੇ ਆਲੇ ਦੁਆਲੇ ਚਿੜੀਆਂ ਨੂੰ ਤੋਤਿਆਂ ਨੂੰ ਮੈਨੂੰ ਉਹਨਾਂ ਦਾ ਚਹਿਚਹਾਉਣਾ ਬੜਾ ਹੀ ਅੱਛਾ ਲੱਗਦਾ ਆ ਇਹਨਾਂ ਸਾਰੇ ਪੰਛੀਆਂ 'ਚ ਮੈਨੂੰ ਜਿਹੜਾ ਸਭ ਤੋਂ ਪਸੰਦ ਹੈ ਉਹ ਹੈ ਤੋਤਾ ਕਿਉਂ ਤੋਤਾ ਸਾਰਿਆਂ ਨੂੰ ਅੱਛਾ ਲੱਗਦਾ ਆ ਕਿਉਂਕਿ ਉਹ ਜੋ ਅਸੀਂ ਬੋਲਦੇ ਹਾਂ ਉਹ ਅੱਗਿਉਂ ਬੋਲਦਾ ਆ ਤੋਤੇ ਨੂੰ ਚੂਰੀ ਪਾਉਣੀ ਜਾਂ ਮਿਰਚ ਪਾਉਣੀ ਮੈਨੂੰ ਬੜੀ ਅੱਛੀ ਲੱਗਦੀ ਆ ਕਿਉਂਕਿ ਸਾਡੇ ਨਾ ਨਾਲ਼ ਦੇ ਪੜੋਸੀਆਂ ਦੇ ਘਰ ਤੋਤਾ ਆ ਅਤੇ ਜਦੋਂ ਵੀ ਮੈਨੂੰ ਫ੍ਰੀ ਟਾਈਮ ਮਿਲਦਾ ਮੈਂ ਉਹਨੂੰ ਜ਼ਰੂਰ ਦੇਖਣ ਜਾਂਦੀ ਹਾਂ ਅਤੇ ਉਹਨੂੰ ਚੂਰੀ ਖੁਆ ਕੇ ਆਉਂਦੀ ਹਾਂ